ਸਾਡੇ ਪਿੰਡ ਗੜਬੱਗਾ ਵਿੱਚ ਨੌਜਵਾਨ ਯੂਥ ਕਲੱਬ ਵੱਲੋਂ ਪਿੰਡ ਵਿੱਚ ਜਿਮ ਦਾ ਪ੍ਰਬੰਧ ਕੀਤਾ ਗਿਆ ਅਤੇ ਨਵੀਂ ਜਿਮ ਖੋਲ੍ਹੀ ਗਈ ਹੈ ਅਤੇ ਇਸ ਜਿਮ ਵਿੱਚ ਜਿਮ ਟ੍ਰੇਨਰ ਨੂੰ ਵੀ ਬੁਲਾਇਆ ਗਿਆ ਹੈ ਅਤੇ ਉਹ ਜਿਮ ਟ੍ਰੇਨਰ ਬਹੁਤ ਹੀ ਵਧੀਆ ਹੈ ਜੋ ਕਿ ਸ਼ੁੱਕਰਵਾਰ ਨੂੰ ਭਾਰ ਵਧਾਉਣ ਅਤੇ ਸਰੀਰ ਬਣਾਉਣ ਦੇ ਨੁਕਤੇ ਦੇਸੀ ਨੁਕਤੇ ਦੱਸਦਾ ਹੈ ਅਤੇ ਜਿਮ ਟ੍ਰੇਨਰ ਸਾਰੀਆਂ ਗੱਲਾਂ ਦਾ ਧਿਆਨ ਵਿੱਚ ਰੱਖਦੇ ਹੋਏ ਸਭ ਨੂੰ ਵਧੀਆ ਨਸੀਹਤਾਂ ਦਿੰਦਾ ਹੈ ਅਤੇ ਵਧੀਆ ਦੇਸੀ ਖੁਰਾਕਾਂ ਬਾਰੇ ਦੱਸਦਾ ਹੈ ਜੋ ਜਿਮ ਟ੍ਰੇਨਰ ਹੈ ਜੋ ਕਿ ਵੈਸ਼ਨੂੰ ਇਨਸਾਨ ਹੈ ਉਸ ਨੂੰ ਪਨੀਰ ਦੁੱਧ ਦਹੀਂ ਮੱਖਣ ਘਿਉ ਪਨੀਰ ਛੋਲੇ ਭੁੱਜੇ ਹੋਏ ਛੋਲੇ ਭਿੱਜੇ ਹੋਏ ਛੋਲੇ ਖਾਣ ਦੀ ਸਲਾਹ ਦਿੰਦਾ ਹੈ ਅਤੇ ਜਿਹੜਾ ਨੋਨ ਵੈਸ਼ਨੂੰ ਬੰਦਾ ਹੈ ਉਸ ਨੂੰ ਚਿਕਨ ਆਂਡੇ ਮੱਛੀ ਆਦਿ ਵਗੈਰਾ ਖਾਣ ਲਈ ਕਹਿੰਦਾ ਹੈ ਅਤੇ ਜਿਮ ਟ੍ਰੇਨਰ ਭਾਰ ਵਧਾਉਣ ਲਈ ਵਧੀਆ ਵਧੀਆ ਖ਼ੁਰਾਕ ਵਧੀਆ ਡਾਈਟ ਪਲੈਨ ਬਾਰੇ ਵੀ ਦੱਸਦਾ ਹੈ ਅਤੇ ਭਾਰ ਵਧਾਉਣ ਵਾਲ਼ੇ ਵਿਅਕਤੀ ਨੂੰ ਦਿਨ ਵਿੱਚ ਦੋ ਦੋ ਡੇਢ ਦੋ ਡੇਢ ਕਿੱਲੋ ਦੁੱਧ ਪੀਣਾ ਚਾਹੀਦਾ ਹੈ ਅਤੇ ਛੇ ਜਾਂ ਦਸ ਬਾਰਾਂ ਕੇਲੇ ਖਾਣੇ ਚਾਹੀਦੇ ਹਨ ਅਤੇ ਭਾਰ ਵਧਾਉਣ ਵਾਲੇ ਵਿਅਕਤੀ ਨੂੰ ਕਸਰਤ ਵੀ ਕਰਨੀ ਚਾਹੀਦੀ ਹੈ ਅਤੇ ਉਸ ਭਾਰ ਵਧਾਉਣ ਵਾਲੇ ਵਿਅਕਤੀ ਨੂੰ ਕਸਰਤ ਪਨੀਰ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਜ਼ਿਆਦਾ ਤਲੀ ਮੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਉਸ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਧਿਆਨ ਰੱਖਣਾ ਪੈਂਦਾ ਹੈ ਅਤੇ ਜਿਮ ਟ੍ਰੇਨਰ ਦੁਆਰਾ ਸਾਰੀਆਂ ਕਸਰਤਾਂ ਯੋਗਾ ਵਗੈਰਾ ਸਭ ਕੁਝ ਦੱਸਿਆ ਜਾਂਦਾ ਹੈ ਅਤੇ ਭਾਰ ਵਧਾਉਣ ਵਾਲੇ ਵਿਅਕਤੀ ਨੂੰ ਜ਼ਿਆਦਾਤਰ ਪਨੀਰ ਛੋਲੇ ਪੌਸ਼ਟਿਕ ਚੀਜ਼ਾਂ ਪੌਸ਼ਟਿਕ ਤੱਤ ਜ਼ਿਆਦਾ ਖਾਣੇ ਚਾਹੀਦੇ ਹਨ ਪਾਣੀ ਪੀਣਾ ਚਾਹੀਦਾ ਸਵੇਰੇ ਉੱਠ ਕੇ ਕਸਰਤ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਹੈਵੀ ਹੈਵੀ ਖਾਣਾ ਖਾਣਾ ਚਾਹੀਦਾ ਹੈ ਜਿਵੇਂ ਕਿ ਪੀਨਟ ਬਟਰ ਹੋ ਗਿਆ ਚਿਕਨ ਪਨੀਰ ਛੋਲੇ ਭੁੱਜੇ ਹੋਏ ਓਟਸ ਦਲ਼ੀਆ ਵਗੈਰਾ ਵਗੈਰਾ ਅਤੇ ਜਿਸ ਨਾਲ਼ ਛੇਤੀ ਭਾਰ ਵਧਣ ਵਿੱਚ ਹੈਲਪ ਹੁੰਦੀ ਹੈ ਜ਼ਿਆਦਾਤਰ ਤਾਂ ਉਸ ਨੂੰ ਡੇਲੀ ਕੇਲੇ ਦਾ ਜੂਸ ਬਨਾਨਾ ਸ਼ੇਕ ਬਣਾ ਕੇ ਪੀਣਾ ਚਾਹੀਦਾ ਹੈ ਅਤੇ ਡੇਲੀ ਦੋ ਜਾਂ ਤਿੰਨ ਆਂਡੇ ਖਾਵੇ ਚਿਕਨ ਖਾਵੇ ਹਫ਼ਤੇ ਵਿੱਚ ਦੋ ਵਾਰੀ ਬੋਇਲ ਆਂਡੇ ਖਾਵੇ ਸਵੇਰੇ ਅਤੇ ਪ੍ਰੀ ਵਰਕਆਊਟ ਤੋਂ ਪਹਿਲਾਂ ਖਾਣਾ ਖਾਣਾ ਖਾਵੇ ਅਤੇ ਪ੍ਰੋਟੀਨ ਪਰੋਟੂਨ ਤੋਂ ਤਾਂ ਦੂਰ ਹੀ ਰਹੇ ਜ਼ਿਆਦਾਤਰ ਕਿਉਂਕਿ ਪ੍ਰੋਟੀਨ ਦਾ ਤਾਂ ਜ਼ਿਆਦਾ ਫਿਰ ਨੁਕਸਾਨ ਹੀ ਹੁੰਦਾ ਹੈ ਇਸ ਕਰਕੇ ਦੇਸੀ ਖ਼ੁਰਾਕ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਵੇਂ ਕਿ ਦੇਸੀ ਘਿਉ ਪਨੀਰ ਛੋਲੇ ਦਲੀਆ ਓਟਸ ਅਤੇ ਟੀਕੇ ਟੂਕਿਆਂ ਤੋਂ ਵੀ ਰਹਿਤ ਹੀ ਦੂਰ ਹੀ ਰਹਿਣਾ ਚਾਹੀਦਾ ਹੈ ਟੀਕੇ ਟੀਕਿਆਂ ਦੇ ਸਾਈਡ ਇਫੈਕਟ ਬਾਰੇ ਫਿਰ ਬਾਅਦ ਵਿੱਚ ਪਤਾ ਲੱਗਦਾ ਹੈ ਜਦੋਂ ਇਨਸਾਨ ਤੋਂ ਚੱਲ ਹਲ ਚੱਲਣ ਦੀ ਹਾਲਤ ਵਿੱਚ ਵੀ ਨਹੀਂ ਉੱਠ ਹੁੰਦਾ ਤਾਂ ਇਸ ਲਈ ਸਾਡਾ ਕਹਿਣਾ ਹੈ ਕਿ ਭਾਰ ਵਧਾਉਣ ਵਾਲੇ ਵਿਅਕਤੀ ਨੂੰ ਦੇਸੀ ਖ਼ੁਰਾਕ ਨੂੰ ਪਹਿਲ ਦੇਣੀ ਚਾਹੀਦੀ ਹੈ ਦੇਸੀ ਖੁਰਾਕ ਖਾਣੀ ਚਾਹੀਦੀ ਹੈ ਸਵੇਰੇ ਸਾਜਰੇ ਉੱਠ ਕੇ ਕਸਰਤ ਕਰਨੀ ਚਾਹੀਦੀ ਹੈ ਡੰਡ ਬੈਠਕਾਂ ਲਾਉਣੀਆਂ ਚਾਹੀਦੀਆਂ ਹਨ ਠੀਕ ਆ ਜੀ